ਸਤਾਈ ਸਤੰਬਰ ਦੋ ਹਜ਼ਾਰ ਇੱਕੀ ਅਠਾਈ ਅਗਸਤ ਦੋ ਹਜ਼ਾਰ ਵੀਹ ਪੱਚੀ ਅਕਤੂਬਰ ਦੋ ਹਜ਼ਾਰ ਪੰਜ ਦਸ ਦਸੰਬਰ ਦੋ ਹਜ਼ਾਰ ਚਾਰ ਅੱਠ ਅਗਸਤ ਦੋ ਹਜ਼ਾਰ ਛੇ